ਮੈਂ ਅਕਸਰ ਹੀ ਸ਼ੋਟ ਆਪਣੇ ਫੋਨ ਦੇ ਕੈਮਰੇ ਨਾਲ ਲੈਂਦੀ ਆ ਕਦੀ ਕਦੀ ਮੈਂ ਦੂਜਾ ਕੈਮਰਾ ਵੀ ਯੂਜ ਕਰਦੀ ਹਾਂ ਪਰ ਜ਼ਿਆਦਾਤਰ ਮੈਂ ਆਪਣਾ ਫੋਨ ਦਾ ਹੀ ਇਸਤੇਮਾਲ ਕਰਦੀ ਹਾਂ ਸ਼ਾਰਟ ਲੈਣ ਦੇ ਸਮੇਂ ਮੈਂ ਸਭ ਤੋਂ ਪਹਿਲਾਂ ਸ਼ਾਟ ਦਾ ਐਂਗਲ ਵੇਖਦੀ ਹਾਂ ਕਿ ਸ਼ੋਟ ਕਿਸ ਐਂਗਲ ਤੋਂ ਲਿਆ ਜਾਵੇ ਜੋ ਕਿ ਵਧੀਆ ਸਾਬਤ ਹੋਵੇ ਇਸ ਤੋਂ ਬਾਅਦ ਮੈਂ ਸ਼ੋਰਟ ਦਾ ਬੈਕਗਰਾਉਂਡ ਵੇਖਦੀ ਹਾਂ ਆਤੇ ਮੈਂ ਕਿਸੇ ਪਹਾੜ ਦਾ ਸ਼ੋਟ ਲੈ ਰਹੀ ਹਾਂ ਜਾਂ ਕਿਸੇ ਹੋਰ ਕੁਦਰਤੀ ਸੀਨ ਦਾ ਸ਼ਾਰਟ ਲੈ ਰਹੀ ਤਾਂ ਉਸਦਾ ਬੈਕਗਰਾਉਂਡ ਪੂਰਾ ਆ ਰਿਹਾ ਕਿ ਨਹੀਂ ਬੈਕਗਰਾਉਂਡ ਸੋਹਣਾ ਲੱਗ ਰਿਹਾ ਕਿ ਨਹੀਂ ਕਿਤੇ ਲਾਈਟ ਤੋਂ ਨਹੀਂ ਪੈ ਰਹੀ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੀ ਹਾਂ ਫਿਰ ਮੈਂ ਇਹਦੇ ਜੇ ਕਿਸੇ ਬੰਦੇ ਦਾ ਇਹ ਕਿਸੇ ਇਨਸਾਨ ਦਾ ਸ਼ਾਰਟ ਲੈ ਰਹੀ ਹਾਂ ਤਾਂ ਉਹਨਾਂ ਦੇ ਪਹਿਰਾਵੇ ਦਾ ਧਿਆਨ ਰੱਖਦੀ ਹਾਂ ਉਹਨਾਂ ਦੇ ਕੱਪੜੇ ਦਾ ਧਿਆਨ ਰੱਖਦੇ ਹਾਂ ਕਿ ਉਹਨਾਂ ਨੇ ਕਿਹੋ ਜਿਹੇ ਕੱਪੜੇ ਪਾਏ ਨੇ ਸ਼ਾਰਟ ਦੇ ਸਮੇਂ ਦਿਨ ਅਤੇ ਰਾਤ ਵੀ ਬਹੁਤ ਮਾਇਨੇ ਰਖਦੇ ਹਨ ਕਦੀ ਕਦੀ ਉਹ ਸ਼ੋਟ ਰਾਤ ਵਿੱਚ ਇੰਨਾ ਸੋਹਣਾ ਆ ਜਾਂਦਾ ਜਿਨਾਂ ਦਿਨ ਵੀ ਸੋਹਣਾ ਨਹੀਂ ਆਉਂਦਾ ਕਿਉਂਕਿ ਲਾਈਟ ਦਾ ਫ਼ਰਕ ਬਹੁਤ ਹੀ ਮਾਇਨੇ ਰੱਖਦਾ ਹੈ ਸ਼ੋਟ ਲੈਣ ਲਈ ਇਸ ਤੋਂ ਬਾਅਦ ਜੇ ਉਸ ਟਾਈਮ 'ਤੇ ਸ਼ੋਰਟ ਵਿੱਚ ਥੋੜ੍ਹੀ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹ ਮੈਂ ਸੰਸ਼ੋਧਨ ਨਾਲ ਸਹੀ ਕਰ ਲੈਂਦੀ ਹਾਂ ਅੱਜ ਕੱਲ੍ਹ ਇੰਟਰਨੈਟ 'ਤੇ ਵੀ ਬਹੁਤ ਸਾਰੀਆਂ ਵੀਡੀਓਜ ਹਨ ਉਹਨਾਂ ਨੂੰ ਵੇਖ ਕੇ ਵੀ ਮੈਂ ਬਹੁਤ ਸਾਰੀ ਉਹ ਮੈਨੂੰ ਮਦਦ ਕਰਦੀਆਂ ਹਨ ਇਸ ਤੋਂ ਬਾਅਦ ਜੇ ਹੋਰ ਕੋਈ ਵੀ ਕਮੀ ਹੁੰਦੀ ਹੈ ਤਾਂ ਅੱਜ ਕੱਲ੍ਹ ਫਿਲਟਰਸ ਵੀ ਉਪਲਬਧ ਹਨ ਇਹਨਾਂ ਫਿਲਟਰਸ ਦਾ ਯੂਜ ਕਰਕੇ ਮੈਂ ਆਪਣੀ ਫੋਟੋ ਨੂੰ ਆਪਣੇ ਚਿੱਤਰ ਨੂੰ ਹੋਰ ਵੀ ਸੋਹਣਾ ਬਣਾ ਲੈਂਦੀ ਹਾਂ ਜੇ ਮੈਨੂੰ ਕਿਤੇ ਵੀ ਕੋਈ ਵੀ ਅੜਚਣ ਆਉਂਦੀ ਹੈ ਤਾਂ ਮੈਂ ਆਪਣੇ ਗੁਰੂ ਨੂੰ ਆਪਣੇ ਦੋਸਤਾਂ ਨੂੰ ਆਪਣੇ ਸਹਾਇਕ ਮਿੱਤਰਾਂ ਨੂੰ ਪੁੱਛ ਲੈਂਦੀ ਹਾਂ ਜੋ ਕਿ ਮੇਰੀ ਹਰ ਵੇਲੇ ਮਦਦ ਕਰਦੇ ਹਨ ਸ਼ਾਰਟ ਲੈਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਐਂਗਲ ਕਿਹੋ ਜਿਹਾ ਜਾ ਰਿਹਾ ਸਾਡਾ ਬੈਕਗਰਾਉਂਡ ਕਿਹੋ ਜਿਹਾ ਜਾ ਰਿਹਾ ਹੈ ਜਾਂ ਸਾਡੇ ਕੈਮਰੇ ਦੀ ਕੁਆਲਿਟੀ ਵੀ ਬਹੁਤ ਮਾਇਨੇ ਰੱਖਦੀ ਹੈ ਇਹਨਾਂ ਸਭ ਚੀਜ਼ਾਂ ਤੋਂ ਮੇਨ ਇਹ ਹੈ ਕਿ ਜੋ ਵੀ ਫੋਟੋਗ੍ਰਾਫਰ ਹੈ ਉਹਦੇ ਅੰਦਰ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਸੰਯਮ ਹੋਣਾ ਚਾਹੀਦਾ ਹੈ ਜੋ ਕਿ ਕੈਮਰਾ ਹਿਲ ਨਾ ਜਾਵੇ ਜਾਂ ਫਿਰ ਜੇ ਸ਼ੋਰਟ ਖ਼ਰਾਬ ਆ ਜਾਂਦਾ ਤਾਂ ਉਹ ਚਿੜਚੜਾ ਹੋ ਕੇ ਉਹ ਸ਼ੋਟ ਛੱਡ ਹੀ ਨਾ ਦੇਵੇ ਉਸਨੂੰ ਬਹੁਤ ਹੀ ਨਿਮਰਤਾ ਨਾਲ ਪਿਆਰ ਨਾਲ ਫੋਟੋਗ੍ਰਾਫੀ ਕਰਨੀ ਚਾਹੀਦੀ ਹੈ ਧੰਨਵਾਦ